ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਹਾਡੀ ਗੱਲ ਮੋਹਾਲੀ ਬੁੱਕ ਸੈਲਰ 'ਚ ਹੋ ਰਹੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਆਪਣੇ ਕੋਲ ਸਾਰੀਆਂ ਤਰ੍ਹਾਂ ਦੀਆਂ ਬੁੱਕਸ ਹੈਗੀਆਂ ਆ ਤੁਸੀਂ ਗੱਲ ਕਰੋ ਤੁਸੀਂ ਕਿਹੜੀ ਬੁੱਕਸ ਲੈਣੀਆਂ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਸਾਰੀਆਂ ਬੁੱਕਸ ਮਿਲ ਜਾਣਗੀਆਂ ਪ੍ਰੋਪਰ ਸੈੱਟ ਮਿਲਜੂਗਾ ਬੁੱਕਸ ਦਾ ਜਿਵੇਂ ਤੁਸੀਂ ਅੱਗੇ ਐਡਮਿਸ਼ਨ ਲੈ ਰਹੇ ਓਂ ਕੋਲੇਜ ਦੇ ਵਿੱਚ ਆਪਣੇ ਕੋਲ ਫਰਸਟ ਸਮੈਸਟਰ ਦੀਆਂ ਹਾਂਜੀ ਹਾਂਜੀ ਤੁਹਾਨੂੰ ਓਹ ਵੀ ਮਿਲ ਜੁਗਾ ਵੈਸੇ ਤੁਸੀਂ ਇੱਥੇ ਵਿਜ਼ਿਟ ਕਰੋਂਗੇ ਸਾਡੀ ਸ਼ੌਪ 'ਤੇ ਜਾਂ ਤੁਸੀਂ ਮੰਗਵਾਉਣਾ ਆ ਹਾਂਜੀ ਹਾਂਜੀ ਆਪਣੇ ਕੋਲ ਸਾਰਾ ਸਮਾਨ ਮਿਲ ਜਾਂਦਾ ਬੁੱਕਸ ਮਿਲ ਜਾਂਦੀਆਂ ਤੁਸੀਂ ਆ ਕੇ ਦੇਖੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਹਿੰਦੀ ਪੰਜਾਬੀ ਇੰਗਲਿਸ਼ ਤਿੰਨੋਂ ਮੀਡੀਅਮ 'ਚ ਪੋਇਟਰੀ ਦੀਆਂ ਬੁੱਕਸ ਮਿਲ ਜਾਣਗੀਆਂ ਤੁਹਾਨੂੰ ਤੁਸੀਂ ਕਿਹੜੇ ਮੀਡੀਅਮ 'ਚ ਲੈਣੀਆਂ ਹਾਂਜੀ ਹਾਂਜੀ ਮਿਲ ਜਾਣਗੀਆਂ ਹਾਂਜੀ ਹਾਂਜੀ ਹਿਸਟਰੀ ਦੀਆਂ ਬੁੱਕਸ ਹੈਗੀਆਂ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਹੜੇ ਲੈਵਲ ਦੀਆਂ ਲੈਣੀਆਂ ਆ ਹਾਂਜੀ ਪਹਿਲਾਂ ਤਾਂ ਸਾਡੇ ਕੋਲ ਹਿੰਦੀ ਪੰਜਾਬੀ ਇੰਗਲਿਸ਼ ਤਿੰਨੋਂ ਮੀਡੀਅਮਸ ਦੇ ਵਿੱਚ ਬੁੱਕਸ ਮਿਲ ਜਾਣਗੀਆਂ ਤੁਹਾਨੂੰ ਜਿਹੜੇ ਵੀ ਰਿਗਾਰਡਿੰਗ ਤੁਸੀਂ ਚਾਹੁੰਦੇ ਹੋ ਹੈ ਨਾ ਅਤੇ ਬਾਕੀ ਫਿਕਸ਼ਨ ਨੌਨ ਫਿਕਸ਼ਨ ਹੋਗੀਆਂ ਲਿਟਰੇਚਰ ਹੋ ਗਿਆ ਪੋਇਟਰੀ ਹੋਗੀਆਂ ਅਤੇ ਹੋਰ ਜਿਵੇਂ ਵੀ ਤੁਹਾਡੀ ਡਿਮਾਂਡ ਹੋਉਗੀ ਆਪਾਂ ਤੁਹਾਨੂੰ ਮੰਗਵਾ ਕੇ ਵੀ ਦੇ ਸਕਦੇ ਹਾਂ ਬੁੱਕਸ ਜੇ ਸਾਡੇ ਕੋਲ ਨਾ ਵੀ ਹੋਈ ਵੈਸੇ ਸਾਡੇ ਕੋਲ ਸਾਰੀਆਂ ਬੁੱਕਸ ਹਾਂਜੀ ਹਾਂਜੀ ਹੋਵੇਗੀ ਬੱਸ ਮੈਮ ਜਿਵੇਂ ਤੁਹਾਨੂੰ ਦੱਸਿਆ ਬੁੱਕਸ ਹੈਗੀਆਂ ਨੇ ਸਾਰੀਆਂ ਅਵੇਲੇਬਲ ਜੇ ਤੁਹਾਨੂੰ ਕੁਝ ਚਾਹੀਦੀ ਚਾਹੀਦੀ ਹੋਈ ਜੇ ਸਾਡੇ ਕੋਲ ਨਾ ਵੀ ਹੋਈ ਤਾਂ ਆਪਾਂ ਤੁਹਾਨੂੰ ਮੰਗਵਾ ਕੇ ਦੇ ਸਕਦੇ ਹਾਂ ਤੁਸੀਂ ਦੱਸ ਸਕਦੇ ਹੋ ਹਾਂਜੀ ਹਾਂਜੀ ਆਪਣੇ ਕੋਲ ਨੋਟ ਬੁੱਕਸ ਹੈਗੀਆਂ ਨੇ ਡਾਈਰਿਸ ਹੈਗੀਆਂ ਹਾਂਜੀ ਹਾਂਜੀ ਬੁੱਕਸ ਦੇ ਨਾਲ ਆਪਾਂ ਸਟੇਸ਼ਨਰੀ ਦਾ ਸਮਾਨ ਵੀ ਰੱਖਦੇ ਹਾਂ ਤੁਹਾਨੂੰ ਉਹ ਸਾਰਾ ਪ੍ਰੋਵਾਈਡ ਕੀਤਾ ਜਾਉਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਹਾਂਜੀ ਹਾਂਜੀ ਜ਼ਰੂਰ ਓਕੇ ਜੀ